ਪੇਂਟਿੰਗ ਸ਼ੁਰੂ ਕਰਨ ਲਈ ਦੇ ਲਈ ਮੈਨੂੰ ਜੋ ਵੀ ਦ੍ਰਿਸ਼ ਚੰਗਾ ਲੱਗਦਾ ਹੈ ਮੈਂ ਉਸ ਦਾ ਸਕੈਚ ਤਿਆਰ ਕਰ ਲੈਂਦੀ ਹਾਂ ਕਈ ਵਾਰ ਮੈਨੂੰ ਕੋਈ ਲੈਂਡਸਕੇਪ ਬਹੁਤ ਹੀ ਵਧੀਆ ਲੱਗਦਾ ਹੈ ਸੀਨ ਦਰੱਖਤ ਕੋਈ ਹੱਟ ਬਣੀ ਮੈਨੂੰ ਬਹੁ ਮੈਂ ਉਸਦਾ ਪੇਂਟਿੰਗ ਸ਼ੁਰੂ ਕਰ ਲੈਂਦੀ ਹੈ ਕਈ ਵਾਰ ਮੈਨੂੰ ਬੱਦਲਾਂ ਦਾ ਦ੍ਰਿਸ਼ ਬਹੁਤ ਵਧੀਆ ਲੱਗਦਾ ਹੈ ਮੈਂ ਉਸਦੀ ਪੇਂਟਿੰਗਸ਼ ਬਣਾ ਲੈਂਦੀ ਹਾਂ ਕਈ ਵਾਰ ਕਈ ਵਾਰ ਪਿਕਸ ਹੁੰਦੀ ਹੈ ਜੋ ਕਿ ਆਪਾਂ ਨੂੰ ਵੇਖਣ ਵਿੱਚ ਬਹੁਤ ਵਧੀਆ ਆਪਣੇ ਮਨ ਨੂੰ ਚੰਗੀ ਲੱਗਦੀ ਹੈ ਜਿਵੇਂ ਪੁਰਾਣੇ ਐਕਟਰਸ ਦੀ ਪਿਕਸ ਐਰਾ ਵਗੈਰਾ ਫਿਰ ਮੈਂ ਉਸ ਦਾ ਸਕੈਚ ਵੀ ਤਿਆਰ ਕਰ ਲੈਂਦੀ ਹਾਂ ਜੋ ਵੀ ਮੇਰੇ ਮਨ ਨੂੰ ਅੱਛਾ ਲੱਗਦਾ ਹੈ ਇਹੋ ਜਿਹੀ ਕੋਈ ਪੰਛੀ ਦਾ ਦ੍ਰਿਸ਼ ਕੋਈ ਪਿਕਚਰ ਪਿਕ ਫੋਟੋ ਦਾ ਕਿਸੇ ਵੀ ਤਰ੍ਹਾਂ ਦਾ ਮੈਂ ਉਹਦਾ ਸਕੈਚ ਤਿਆਰ ਕਰਕੇ ਪੇਂਟਿੰਗ ਤਿਆਰ ਕਰਦੀ ਹਾਂ ਪੇਟਿੰਗ ਤਿਆਰ ਕਰ ਲੈਂਦੀ ਹਾਂ ਕਈ ਵਾਰ ਅਸੀਂ ਕਿਤੇ ਬਾਹਰ ਘੁੰਮਣ ਜਾਂਦੇ ਹਾਂ ਆਪਾਂ ਨੂੰ ਉਥੋਂ ਬਹੁਤ ਵਧੀਆ ਵਧੀਆ ਦ੍ਰਿਸ਼ ਵੇਖਣ ਨੂੰ ਮਿਲਦੇ ਹਨ ਜਿਸ ਨੂੰ ਵੇਖ ਕੇ ਆਪਣਾ ਦਿਲ ਕਰਦਾ ਹੈ ਕਿ ਅਸੀਂ ਇਸ ਦ੍ਰਿਸ਼ ਦੀ ਪੇਂਟਿੰਗ ਜ਼ਰੂਰ ਤਿਆਰ ਕਰੀਏ ਇਸ ਤਰ੍ਹਾਂ ਤਿਆਰ ਕਰੀਏ ਮੈਂ ਉਸਦੀ ਪੇਂਟਿੰਗ ਉਸ ਤਰ੍ਹਾਂ ਹੀ ਘਰ ਆ ਕੇ ਆਪਣਾ ਸਕੈਚ ਤਿਆਰ ਕਰਕੇ ਉਹਦੇ ਵਿੱਚ ਉਸ ਤਰ੍ਹਾਂ ਦੇ ਹੀ ਕਲਰ ਕਰਨ ਦੀ ਕੋਸ਼ਿਸ਼ ਕਰਦੀ ਹਾਂ ਜੋ ਕਿ ਮੇਰੇ ਮਨ ਨੂੰ ਵਧੀਆ ਲੱਗਦੇ ਹਨ ਔਰ ਅਤੇ ਮੇਰੇ ਮਨ ਨੂੰ ਸਕੂਨ ਮਿਲਦਾ ਹੈ ਪੇਂਟਿੰਗ ਕਰਕੇ ਇਸ ਤਰ੍ਹਾਂ ਪੇਂਟਿੰਗ ਮੇਰਾ ਇੱਕ ਬਹੁਤ ਹੀ ਪਸੰਦੀਦਾ ਸਬਜੈਕਟ ਹੈ